ਸਿੱਖਿਆ ਨੇ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਅ ਪ੍ਰਭਾਵ ਪਾਇਆ ਹੈ ਇਸ ਨਾਲ ਜਿੱਥੇ ਲੋਕਾਂ ਦਾ ਜੀਵਨ ਰਹਿਣ ਸਹਿਣ ਉੱਚਾ ਹੋਇਆ ਹੈ ਅਤੇ ਪਰ ਇਸ ਨੇ ਕਈ ਕੁਛ ਅਜਿਹੇ ਕੰਮ ਆ ਵੀ ਕਰੀਆਂ ਹਨ ਜਿਸ ਨਾਲ ਲੋਕ ਆਪਣੇ ਸੱਭਿਆਚਾਰ ਨਾਲੋਂ ਟੁੱਟ ਗਏ ਹਨ